ਹੈਲੋ ਸਤਿ ਸ਼੍ਰੀ ਅਕਾਲ ਮੈੈਮ ਹਾਂਜੀ ਮੈਮ ਜਿਹੜੇ ਪੰਜਾਬ ਅਸੀਂ ਕੁਛ ਪੁੱਛਣਾ ਚਾਹੁੰਦੇ ਮੈਮ ਜਿਹੜੇ ਪੰਜਾਬ ਦੇ ਐਕਟਰ ਆ ਅ ਜੋ ਹਿੰਦੀ ਫਿਲਮਾਂ 'ਚ ਕੰਮ ਕਰਦੇ ਆ ਉਹਨਾਂ ਬਾਰੇ ਜਾਣਕਾਰੀ ਤੁਸੀਂ ਦਿਓਗੇ ਸਾਨੂੰ

ਹਾਂਜੀ ਹਾਂਜੀ ਜੀ ਹਾਂਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਸਾਨੂੰ ਬਹੁਤ ਬਹੁਤ ਧੰਨਵਾਦ ਓਕੇ